ਅੱਜ ਕੱਲ੍ਹ ਬਦਲਦੇ ਸਮੇਂ ਦੇ ਨਾਲ ਧਾਰਮਿਕ ਅਭਿਆਸਾਂ ਅਤੇ ਸੱਭਿਆਚਾਰ ਵਿੱਚ ਤਕਨੀਕੀ ਨਵੀਨਤਾਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਇਹਨਾਂ ਨਵੀਨਤਾਵਾਂ ਨੇ ਜਿੱਥੇ ਸਾਡੀ ਜ਼ਿੰਦਗੀ ਸੁਖਾਲੀ ਕੀਤੀ ਹੈ ਉੱਥੇ ਹੀ ਸਾਨੂੰ ਧਰਮ ਅਤੇ ਸੱਭਿਆਚਾਰ ਦੇ ਨਾਲ ਹੋਰ ਵੀ ਜ਼ਿਆਦਾ ਜੋੜ ਦਿੱਤਾ ਹੈ ਇਹਨਾਂ ਨਵੀਨਤਾਵਾਂ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤਾਂ ਡਿਜੀਟਲਲਾਈਜੇਸ਼ਨ ਬਹੁਤ ਜ਼ਿਆਦਾ ਹੋ ਚੁੱਕੀ ਹੈ ਜਿਵੇਂ ਕਿ ਸਿੱਖ ਧਰਮ ਦੇ ਵਿੱਚ ਲਗਾਈਏ ਤਾਂ ਸਾਡਾ ਸਭ ਤੋਂ ਉਪਰ ਮੰਨਿਆਂ ਜਾਣ ਵਾਲਾ ਧਾਰਮਿਕ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਜੋ ਕਿ ਅੰਮ੍ਰਿਤਸਰ ਵਿਖੇ ਹੈ ਉੱਥੋਂ ਰੋਜ਼ ਹੀ ਗੁਰਬਾਣੀ ਦਾ ਜਿਹੜਾ ਪ੍ਰਸਾਰਨ ਹੈ ਉਹ ਪੀ ਟੀ ਸੀ ਨਿਊਜ਼ ਅਤੇ ਯੂਟੀਊਬ ਚੈਨਲ ਦੇ ਉੱਪਰ ਵੀ ਕੀਤਾ ਜਾ ਰਿਹਾ ਹੈ ਸੰਸਾਰ ਵਿੱਚ ਵਕ ਵਸਦੇ ਵੱਖ ਵੱਖ ਥਾਵਾਂ 'ਤੇ ਸਿੱਖ ਜੋ ਕਿ ਹਰਿਮੰਦਰ ਸਾਹਿਬ ਫਿਜੀਕਲ ਤੌਰ 'ਤੇ ਨਹੀਂ ਜਾ ਸਕਦੇ ਉਹ ਉਸ ਗੁਰਬਾਣੀ ਦਾ ਆਨੰਦ ਆਪਣੇ ਘਰ ਬੈਠੇ ਹੀ ਮਾਣ ਸਕਦੇ ਹਨ ਉਹ ਆਪਣੇ ਬੱਚਿਆਂ ਨੂੰ ਵੀ ਗੁਰਸਿੱਖ ਬਣਾ ਸਕਦੇ ਹਨ ਅਤੇ ਆਪਣੇ ਬੱਚਿਆਂ ਨੂੰ ਤ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਵਾ ਸਕਦੇ ਹਨ ਇਸ ਤਰ੍ਹਾਂ ਹੀ ਡਿਜੀਟਲਲਾਈਜੇਸ਼ਨ ਨੇ ਸਾਨੂੰ ਸਾਡੇ ਗੁਰੂਆਂ ਦੇ ਨਾਮ ਸਾਡੇ ਸੱਭਿਆਚਾਰ ਸਾਡੇ ਪਹਿਰਾਵੇ ਇਹਨਾਂ ਚੀਜ਼ਾਂ ਦੇ ਨਾਲ ਬਹੁਤ ਹੀ ਨੇੜੇ ਕਰ ਦਿੱਤਾ ਹੈ ਇਸੇ ਤਰ੍ਹਾਂ ਹੀ ਅਗਰ ਕੋਈ ਦੂਰ ਬੈਠਾ ਹੋਇਆ ਸਿੱਖ ਸਾਡੇ ਸੱਭਿਆਚਾਰਕ ਜਿਵੇਂ ਕਿ ਪਹਿਰਾਵੇ ਸੂਟ ਲਹਿੰਗੇ ਜਾਂ ਫਿਰ ਕੋਈ ਵੀ ਪੰਜਾਬੀ ਪਹਿਰਾਵਾ ਪਹਿਨਣਾ ਚਾਹੁੰਦਾ ਹੈ ਤਾਂ ਪਹਿਲਾਂ ਉਹਨਾਂ ਨੂੰ ਇੰਡੀਆ ਆ ਕੇ ਪੰਜਾਬ ਵਿੱਚੋਂ ਇਹ ਖਰੀਦਦਾਰੀ ਕਰਨੀ ਪੈਂਦੀ ਸੀ ਪਰ ਅੱਜ ਕੱਲ੍ਹ ਦੀ ਮੋਡਰਨ ਸਮੇਂ ਦੇ ਵਿੱਚ ਲੋਕ ਇੱਥੋਂ ਹੀ ਔਨਲਾਈਨ ਔਡਰ ਕਰ ਦਿੰਦੇ ਹਨ ਉਹ ਆਪਣਾ ਸਹੀ ਨਾਪ ਦੇ ਕੇ ਇਹ ਇਹਦੇ ਨਾਲ ਹੀ ਸੂਟ ਸਵਾ ਵੀ ਸਕਦੇ ਹਨ ਅਤੇ ਇੱਕ ਬਹੁਤ ਹੀ ਪੈਸਿਆਂ ਦੇ ਪੈ ਪੈਸੇ ਦੇ ਕੇ ਜਾਂ ਉਹਨਾਂ ਦੀ ਪੇਮੈਂਟ ਕਰਕੇ ਉਹ ਇੱਕ ਅੱਛਾ ਸੂਟ ਜਾਂ ਲਹਿੰਗਾ ਸੰਸਾਰ ਦੇ ਕਿਸੇ ਵੀ ਹੋਰ ਖੇਤਰ ਦੇ ਵਿੱਚ ਮੰਗਵਾ ਸਕਦੇ ਹਨ ਤਾਂ ਸਾਡੇ ਧਾਰਮਿਕ ਅਭਿਆਸਾਂ ਅਤੇ ਸੱਭਿਆਚਾਰ ਦੇ ਵਿੱਚ ਆਈਆਂ ਨਵੀਆਂ ਨਵੀਨਤਾਵਾਂ ਨੇ ਜਿੱਥੇ ਕੁਛ ਕੁਰੀਤੀਆਂ ਵੀ ਪਾਈਆਂ ਹਨ ਪਰ ਮੈਂ ਸਮਝਦੀ ਹਾਂ ਕਿ ਇਹਨਾਂ ਨੇ ਕਿਤੇ ਨਾ ਕਿਤੇ ਸਾਨੂੰ ਸਾਡੇ ਸੱਭਿਆਚਾਰ ਅਤੇ ਸਾਡੇ ਧਰਮ ਦੇ ਨਾਲ ਜ਼ਿਆਦਾ ਜੋੜ ਦਿੱਤਾ ਹੈ